ਮੈਂ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਿੰਡ ਦੀ ਰਹਿਣ ਵਾਲੀ ਸਾਡੇ ਪਿੰਡ ਦੇ ਵਿੱਚ ਪਾਣੀ ਦੇ ਵੱਖ ਵੱਖ ਸਰੋਤ ਹਨ ਸਭ ਤੋਂ ਪਹਿਲਾਂ ਪਾਣੀ ਲਈ ਸਰਕਾਰੀ ਟੈਂਕੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿੱਚ ਘਰ ਘਰ ਸਰਕਾਰੀ ਟੂਟੀਆਂ ਲੱਗੀਆਂ ਹੋਈਆਂ ਹਨ ਇਹਨਾਂ ਟੂਟੀਆਂ ਰਾਹੀਂ ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਪਾਣੀ ਆਉਂਦਾ ਹੈ ਇਸ ਕਰਕੇ ਕੋਈ ਸਮੱਸਿਆ ਨਹੀਂ ਆਉਂਦੀ ਬਾਕੀ ਹਰੇਕ ਨੇ ਆਪਣੇ ਆਪਣੇ ਘਰ ਦੇ ਵਿੱਚ ਮੱਛੀ ਮੋਟਰ ਲਾਈ ਹੋਈ ਹੈ ਇਸ ਮੋਟਰ ਰਾਹੀਂ ਅਸੀਂ ਇਹਨਾਂ ਪਾਣੀ ਦੀਆਂ ਟੈਂਕੀਆਂ ਨੂੰ ਭਰ ਲੈਂਦੇ ਹਾਂ ਜਿਹਦੇ ਕਰਕੇ ਪਾਣੀ ਦੀ ਸਮੱਸਿਆ ਕਦੇ ਨਹੀਂ ਆਉਂਦੀ ਪਾਣੀ ਦਾ ਸਰੋਤ ਪੂਰੇ ਸਾਲ ਉਪਲਬਧ ਰਹਿੰਦਾ ਹੈ ਟੂਟੀਆਂ ਰਾਹੀਂ ਸਤਲੁਜ ਦਰਿਆ ਦੇ ਨੇੜੇ ਹੋਣ ਕਾਰਨ ਪਾਣੀ ਦਾ ਲੈਵਲ ਵੀ ਪੂਰਾ ਆਉਂਦਾ ਹੈ ਇਸ ਕਰਕੇ ਪਾਣੀ ਦੀ ਸਮੱਸਿਆ ਨੂੰ ਜੂਝਣ ਵਾਸਤੇ ਕੋਈ ਜ਼ਿਆਦਾ ਮਿਹਨਤ ਅਤੇ ਮਸ਼ੱਕਤ ਕਰਨ ਦੀ ਲੋੜ ਨਹੀਂ ਜਾਪਦੀ ਜਿਵੇਂ ਜਿਵੇਂ ਪਾਣੀ ਦੇ ਸਰੋਤ ਵਧਦੇ ਗਏ ਉਵੇਂ ਉਵੇਂ ਪਿੰਡਾਂ ਦੇ ਵਿੱਚ ਸਾਡੇ ਇਹ ਸਰੋਤ ਵੱਧਦੇ ਨਜ਼ਰ ਆ ਰਹੇ ਹਨ ਜਿਸ ਤਰ੍ਹਾਂ ਪਾਣੀ ਦੀ ਸਮੱਸਿਆ ਪਹਿਲਾਂ ਸੀ ਹੁਣ ਉਸ ਤਰ੍ਹਾਂ ਨਹੀਂ ਰਹੀ ਪੁਰਾਣੇ ਸਮੇਂ ਦੇ ਖੂਹਾਂ ਨਾਲ ਹੁੰਦੀ ਖੇਤੀ ਅੱਜ ਨਹਿਰਾਂ ਅਤੇ ਨਦੀਆਂ ਦੇ ਵਿੱਚ ਬਦਲ ਚੁੱਕੀ ਹੈ ਪਾਣੀ ਦੇ ਵੱਖ ਵੱਖ ਸਰੋਤ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਬਰਾਬਰ ਆ ਗਏ ਹਨ